ਹਾਂਜੀ ਸਰ ਗੁਰੂ ਤੇਗ ਬਹਾਦਰ ਕਾਲਜ ਦੀ ਕੰਟੀਨ 'ਚੋਂ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਸਰ ਅਸੀਂ ਵੀ ਉਹ ਗੁਰੂ ਤੇਗ ਬਹਾਦਰ ਕਾਲਜ ਦੇ ਸਟੂਡੈਂਟ ਬੋਲ ਰਹੇ ਹਾਂ ਸਰ ਅਸੀਂ ਨਾ ਤੁਹਾਡੀ ਕੰਟੀਨ ਬਾਰੇ ਗੱਲ ਕਰਨੀ ਸੀਗੀ ਕਿਉਂਕਿ ਅਸੀਂ ਤੁਹਾਡੀ ਕ ਦੇ ਵਿੱਚੋਂ ਚਾਹ ਪਾਣੀ ਪੀਂਦੇ ਹਾਂ ਲ ਖਾਣਾ ਖੂਣਾ ਖਾਂਦੇ ਹਾਂ ਅਤੇ ਜਿਹੜੀ ਚਾਹ ਪਾਣੀ ਪੀਂਦੇ ਹਾਂ ਸਰ ਬਿਲਕੁਲ ਵੀ ਸਵਾਦ ਨਹੀਂ ਹੁੰਦੀ ਗੀ ਮਤਲਬ ਪਾਣੀ ਜਿਹਾ ਹੀ ਹੁੰਦਾ ਚਾਹ ਵੀ ਕੌਫੀ ਵੀ ਕੁਛ ਵੀ ਨਹੀਂ ਸਵਾਦ ਹੁੰਦਾ ਅਤੇ ਜਿਹੜਾ ਅਸੀਂ ਖਾਣਾ ਖਾਂਦੇ ਹਾਂ ਠੀਕ ਹੈ ਜਿੱਥੇ ਬਹਿ ਕੇ ਜਿੱਥੇ ਥੜੇ ਜਿਹੇ ਬਣੇ ਹੋਏ ਨੇ ਉਥੋਂ ਇੰਨੀ ਗੰਦੀ ਸਮੈਲ ਆਉਂਦੀ ਆ ਜੇ ਅਸੀਂ ਕੋਲ ਬੈਠੇ ਖਾਣਾ ਵੀ ਖਾ ਰਹੇ ਹਾਂ ਨਾ ਅਤੇ ਸਾਨੂੰ ਪਹਿਲੀ ਗੱਲ ਤਾਂ ਸਮੈਲ ਹੀ ਚੜ੍ਹੀ ਜਾਂਦੀ ਸਾਥੋਂ ਕੁਛ ਖਾਧਾ ਪੀਤਾ ਵੀ ਨਹੀਂ ਜਾਂਦਾ ਅਤੇ ਤੁਹਾਡੀ ਕੰਟੀਨ ਦੇ ਵਿੱਚ ਜਿਹੜਾ ਵੀ ਸਮਾਨ ਪਿਆ ਹੁੰਦਾ ਉਹ ਇੱਦਾਂ ਹੀ ਪਿਆ ਹੁੰਦਾ ਕੋਈ ਪੈਰਾਂ ਨਾਲ ਉਹ ਕਰੀ ਜਾਂਦਾ ਗਾ ਉੱਥੇ ਆਲੂ ਵਗੈਰਾ ਤੁਸੀਂ ਐਂ ਸਿੱਟ ਰੱਖੇ ਆ ਸਾਰਾ ਸਮਾਨ ਤੁਸੀਂ ਆਏਂ ਸਿੱਟਿਆ ਹੋਇਆ ਕੁਛ ਵੀ ਕੀਤਾ ਅਤੇ ਉਹ ਐਵੇਂ ਹੀ ਪਿਆ ਹੁੰਦਾ ਸਰ ਉਹ ਫਿਰ ਬੱਚਿਆਂ ਨੂੰ ਕ ਜੇ ਉਹੀ ਬੱਚੇ ਖਾਂਦੇ ਆ ਤਾਂ ਉਹੀ ਇਨਫੈਕਸ਼ਨ ਵਗੈਰਾ ਪੇਟ 'ਚ ਹੋ ਜਾਂਦੀ ਆ ਬੱਚੇ ਕਾਫੀ ਜ਼ਿਆਦੇ ਬਿਮਾਰ ਵੀ ਹੋਏ ਪਏ ਨੇ ਸਰ ਪਲੀਜ਼ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਕਿਉਂਕਿ ਠੀਕ ਹੈ ਜੀ ਬਹੁਤ ਜ਼ਿਆਦੇ ਐਂ ਹੁੰਦਾ ਠੀਕ ਆ ਅਸੀਂ ਖਾਣਾ ਪੀਣਾ ਵੀ ਹੁੰਦਾ ਗਾ ਹੁਣ ਕਈ ਬੱਚੇ ਤਾਂ ਜਿਹੜੇ ਘਰੋਂ ਖਾਣਾ ਨਹੀਂ ਲੈ ਕੇ ਆਉਂਦੇ ਗੇ ਉਹਨਾਂ ਨੇ ਤਾਂ ਇੱਥੋਂ ਹੀ ਖਾਣਾ ਪੀਣਾ ਹੁੰਦਾ ਅਤੇ ਉਹ ਬਾਹਰੋਂ ਨਹੀਂ ਖਾ ਪੀ ਸਕਦੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਜੇ ਫਰੈਸ਼ ਫੂਡ ਮਿਲ ਜੇ ਤਾਂ ਅਸੀਂ ਇੱਥੋਂ ਹੀ ਪਰਚੇਸ ਕਰ ਲਏ ਨਹੀਂ ਤਾਂ ਫਿਰ ਸਰ ਅਸੀਂ ਕਾਲਜ ਤੋਂ ਨਹੀਂ ਕੁਝ ਖਾਂਦੇ ਪੀਂਦੇ ਅਸੀਂ ਬਾਹਰੋਂ ਖਾਣ ਪੀਣ ਲੱਗ ਜਾਂਗੇ ਠੀਕ ਹੈ ਸਰ ਓਕੇ